ਜੇ ਸਾਡੇ ਨੇੜੇ ਤੇੜੇ ਸਾਡੇ ਪਿੰਡ 'ਚ ਜਾਂ ਫਿਰ ਕਿਸੇ ਹੋਰ ਪਿੰਡ ਜਾਂ ਸਾਡੀ ਜ਼ਮੀਨ ਦੇ ਨੇੜੇ ਤੇੜੇ ਕਿਸੇ ਨੂੰ ਸੱਪ ਕੱਟ ਜਾਂਦਾ ਹੈ ਤਾਂ ਸਭ ਤੋਂ ਪਹਿਲੇ ਅਸੀਂ ਉਹਨੂੰ ਫਸਟ ਏਡ ਦੇ ਰੂਪ ਵਿੱਚ ਕੀ ਹੈ ਕਿ ਅਸੀਂ ਕਿਸੇ ਤਿੱਖੀ ਚੀਜ਼ ਜਾਂ ਫਿਰ ਚਾਕੂ ਨੂੰ ਗਰਮ ਕਰਕੇ ਉਹਦੇ ਘਾਲ 'ਤੇ ਅਸੀਂ ਕੱਟ ਲਾਵਾਂਗੇ ਕੱਟ ਲਾਉਣ ਨਾਲ ਅੰਦਰ ਜ਼ਹਿਰ ਜਿਹੜਾ ਹੈ ਉਹ ਥੋੜ੍ਹਾ ਹਲਕਾ ਹੋ ਜਾਵੇਗਾ ਇਹਦੇ 'ਚ ਉਹਨੂੰ ਥੋੜ੍ਹੀ ਮਦਦ ਮਿਲ ਜਾਵੇਗੀ ਥੋੜ੍ਹਾ ਰਿਲੀਫ ਮਿਲ ਜਾਵੇਗਾ ਉਸ ਤੋਂ ਬਾਅਦ ਅਸੀਂ ਗਰਮ ਪਾਣੀ ਦੇ ਨਾਲ ਉਬਲਦੇ ਗਰਮ ਪਾਣੀ ਦੇ ਨਾਲ ਉਹਨੂੰ ਸਾਫ਼ ਕਰਾਂਗੇ ਤਾਂ ਕੀ ਅਸਰ ਥੋੜ੍ਹਾ ਘੱਟ ਹੋਜੇ ਇਸ ਤੋਂ ਬਾਅਦ ਅਸੀਂ ਤੁਰੰਤ ਹੀ ਉਹਨੂੰ ਨੇੜੇ ਦੇ ਨੇੜੇ ਦੇ ਕਿਸੇ ਹੋਸਪਿਟਲ ਲੈ ਕੇ ਜਾਵਾਂਗੇ ਹਸਪਤਾਲ ਲੈ ਕੇ ਜਾਵਾਂਗੇ ਉਹਦਾ ਇਲਾਜ ਚਾਲੂ ਕਰਵਾਵਾਂਗੇ ਅਤੇ ਜੋ ਵੀ ਡਾਕਟਰ ਦਵਾਈ ਦੇਗਾ ਉਹ ਜਾਂ ਜੋ ਵੀ ਟੀਕੇ ਉਹਨੂੰ ਲੱਗਣਗੇ ਅਸੀਂ ਨਾਲ ਦੀ ਨਾਲ ਉਹ ਖਰੀਦ ਕੇ ਉਹਦੇ ਨਾਲ ਉਹਦੀ ਉਹਦਾ ਇਲਾਜ ਸ਼ੁਰੂ ਕਰਾਵਾਂਗੇ ਧੰਨਵਾਦ ਜੀ